ਸਾਡੇ ਦੇਸ਼ ਵਿੱਚ ਹਸਪਤਾਲਾਂ ਅਤੇ ਡਾਕਟਰੀ ਸੇਵਾਵਾਂ ਦੀ ਹਾਲਤ ਕੁਝ ਜ਼ਿਆਦਾ ਵਧੀਆ ਨਹੀਂ ਹਨ ਜਿਹੜੇ ਤਾਂ ਸਰਕਾਰੀ ਹਸਪਤਾਲ ਹਨ ਉਹਨਾਂ ਦੀ ਹਾਲਤ ਪ੍ਰਾਈਵੇਟ ਹਸਪਤਾਲਾਂ ਨਾਲੋਂ ਬਹੁਤ ਹੀ ਘਟੀਆ ਹੈ ਅਤੇ ਪ ਪ੍ਰਾਈਵੇਟ ਹਸਪਤਾਲਾਂ ਵਿੱਚ ਖਰਚਾ ਕਰਨਾ ਆਮ ਬੰਦੇ ਦੇ ਵਸ ਵਿੱਚ ਨਹੀਂ ਪ੍ਰਾਈਵੇਟ ਹਸਪਤਾਲ ਬਹੁਤ ਹੀ ਮਹਿੰਗੇ ਨੇ ਸਰਕਾਰੀ ਹਸਪਤਾਲ ਵਿੱਚ ਕੋਈ ਵੀ ਸੁਵਿਧਾ ਨਹੀਂ ਮਿਲਦੀ ਹੁਣ ਤੋਂ ਕੁਝ ਸਾਲ ਪਹਿਲਾਂ ਤਾਂ ਇਹਨਾਂ ਦੀ ਹਾਲਤ ਬਹੁਤ ਠੀਕ ਸੀ ਪਰ ਅੱਜ ਕੱਲ੍ਹ ਦਿਨੋਂ ਦਿਨ ਹਾਲਤ ਇਹਨਾਂ ਦੀ ਵਿਗੜਦੀ ਜਾ ਰਹੀ ਹੈ ਦੋ ਹਜ਼ਾਰ ਵੀਹ ਵਿੱਚ ਆਈ ਕੋਵਿਡ ਮਹਾਂਮਾਰੀ ਨੇ ਵੀ ਦੇਸ਼ 'ਤੇ ਬਹੁਤ ਬੁਰਾ ਪ੍ਰਭਾਵ ਪਾਇਆ ਹੈ ਇਸ ਸਮੇਂ ਹਸਪਤਾਲਾਂ ਵਿੱਚ ਮਰੀਜ਼ ਭਰੇ ਪਏ ਸਨ ਅਤੇ ਕੋਈ ਵੀ ਦਵਾਈ ਅਸਰ ਨਹੀਂ ਸੀ ਕਰ ਰਹੀ ਬਾਕੀ ਕੋਵਿਡ ਨੇ ਕੰਮਕਾਰ 'ਤੇ ਵੀ ਬਹੁਤ ਬੁਰਾ ਅਸਰ ਪਾਇਆ ਹੈ ਜੋ ਉਸ ਸਮੇਂ ਬੰਦ ਰਿਹਾ ਸੀ ਅਤੇ ਹੁਣ ਤੱਕ ਸਹੀ ਨਹੀਂ ਹੋਇਆ ਬਾਕੀ ਸਾਡੇ ਖੇਤਰ ਵਿੱਚ ਹਸਪਤਾਲਾਂ ਦੀ ਬੇਹਤਰੀ ਲਈ ਸਰਕਾਰ ਨੂੰ ਉਪਰਾਲਾ ਕਰਨਾ ਚਾਹੀਦਾ ਹੈ ਕਿ ਇਸ ਵਿੱਚ ਡਾਕਟਰਾਂ ਦੀ ਗਿਣਤੀ ਪੂਰੀ ਕੀਤੀ ਜਾਵੇ ਦਵਾਈਆਂ ਅਤੇ ਹੋਰ ਮੈਡੀਕਲ ਕਿੱਟਾਂ ਦੀ ਸੁਵਿਧਾ ਵੀ ਹੋਣੀ ਚਾਹੀਦੀ ਹੈ